ਜੇਕਰ ਤਸਵੀਰਾਂ ਰਾਹੀਂ ਮੈਨੂੰ ਭਾਰਤ ਨੂੰ ਦਿਖਾਉਣ ਦਾ ਮੌਕਾ ਮਿਲੇ ਤਾਂ ਸਭ ਤੋਂ ਪਹਿਲਾਂ ਮੈਂ ਆਪਣੀ ਤਸਵੀਰ ਆਪਣੀ ਪੱਗ ਦੇ ਨਾਲ ਪਾਵਾਂਗਾ ਮੇਰੀ ਪੱਗ ਜੋ ਮੇਰਾ ਪਰਾਈਡ ਹੈ ਮੈਂ ਤਿੰਨ ਕਲਰ ਦੀ ਪੱਗ ਸਜਾਵਾਂਗਾ ਜਿਵੇਂ ਪਹਿਲੇ ਨੰਬਰ 'ਤੇ ਕੇਸਰੀ ਅਤੇ ਉਸ ਦੇ ਵਿਚਕਾਰ ਸਫੇਦ ਅਤੇ ਉਸ ਤੋਂ ਨੀਚੇ ਹਰਾ ਕਲਰ ਇਹਨਾਂ ਤਿੰਨਾਂ ਕਲਰਾਂ ਦੀ ਜੇ ਪੱਗ ਮੈਂ ਬੰਨਾਂਗਾ ਅਤੇ ਜੇ ਮੈਂ ਇਸ ਦੇ ਨਾਲ ਆਪਣੀ ਇਸ ਪੱਗ ਦੇ ਨਾਲ ਸੈਲਫੀ ਖਿੱਚ ਕੇ ਪਾਵਾਂਗਾ ਤਾਂ ਮੈਨੂੰ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਪਵੇਗੀ ਅਤੇ ਵਿਦੇਸ਼ੀ ਲੋਕ ਵੀ ਮੇਰੀ ਤਸਵੀਰ ਵੇਖ ਕੇ ਸਮਝ ਜਾਣਗੇ ਕਿ ਮੈਂ ਇੰਡੀਆ ਤੋਂ ਬਿਲੋਂਗ ਕਰਦਾ ਹਾਂ ਮੇਰੀ ਪੱਗ ਨੂੰ ਦੇਖ ਕੇ ਮੇਰੀ ਪੱਗ ਦੀ ਇੰਨੀ ਪਹਿਚਾਣ ਹੈ ਸਾਡੇ ਲੋਕਾਂ ਨੇ ਬਣਾਈ ਕਿ ਸਾਨੂੰ ਲੋਕ ਦੂਰੋਂ ਹੀ ਸਾਡੀ ਪਹਿਚਾਣ ਕਰ ਲੈਂਦੇ ਹਨ ਕਿ ਅਸੀਂ ਇੰਡੀਅਨ ਹਾਂ ਸਾਨੂੰ ਇੰਨਾਂ ਜੋ ਸੰਸਾਰ ਦੇ ਵਿੱਚ ਮਾਣ ਮਿਲਦਾ ਹੈ ਉਹ ਸਾਡੀ ਪੱਗ ਦੇ ਕਾਰਨ ਹੈ ਅਤੇ ਇਸ ਨਾਲ ਤਸਵੀਰ ਪਾਉਣ ਦੇ ਨਾਲ ਸਾਡੀ ਪਹਿਚਾਣ ਆਪਣੇ ਆਪ ਹੋ ਜਾਂਦੀ ਹੈ ਜੋ ਸਾਨੂੰ ਦੱਸਣ ਦੀ ਲੋੜ ਵੀ ਨਹੀਂ ਪਏਗੀ